ਹਾਂਜੀ ਜੇ ਆਪਾਂ ਹਿੰਦੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਦਾ ਆਪਸ ਦੇ ਵਿੱਚ ਤੁਲਨਾ ਕਰਦੇ ਹਾਂ ਕਿ ਹਿੰਦੀ ਅਤੇ ਪੰਜਾਬੀ ਜੋ ਕਿ ਅ ਹਿੰਦੀ ਸਰਕਾਰੀ ਭਾਸ਼ਾ ਦੇ ਤੌਰ 'ਤੇ ਯੂਜ ਹੁੰਦੀ ਹੈ ਪੰਜਾਬੀ ਨਾਲ ਕਿੰਨੀ ਕੁ ਮੇਲ ਖਾਂਦੀ ਹੈ ਤਾਂ ਮੈਂ ਕਹਿਣਾ ਚਾਹੁੰਦਾ ਵੀ ਜੋ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਨੇ ਜੋ ਹਿੰਦੀ ਨਾਲ ਮੇਲ ਖਾਂਦੇ ਨੇ ਬਿਲਕੁਲ ਜਿਵੇਂ ਖੁਸ਼ੀ ਖੁਸ਼ੀ ਗਮੀ ਸਕੂਲ ਹਸਪਤਾਲ ਐਸੇ ਸ਼ਬਦ ਨੇ ਜੋ ਮਤਲਬ ਹਿੰਦੀ ਦੇ ਵਿੱਚ ਵੀ ਬਿਲਕੁਲ ਹੂ ਬ ਹੂ ਸੇਮ ਹੀ ਨੇ ਅਤੇ ਪੰਜਾਬੀ ਦੇ ਵਿੱਚ ਵੀ ਸੇਮ ਹੀ ਨੇ ਅਤੇ ਬਾਕੀ ਜੇ ਗੱਲ ਦਫ਼ਤਰਾਂ ਵਿੱਚ ਜਾਂ ਸਰਕਾਰੀ ਜੋ ਵੀ ਅਦਾਰੇ ਨੇ ਉਨ੍ਹਾਂ ਵਿੱਚ ਉਨ੍ਹਾਂ ਦੀ ਕੀਤੀ ਜਾਵੇ ਤਾਂ ਓਥੇ ਵੀ ਜੋ ਬੰਦਾ ਪੰਜਾਬੀ ਬੋਲ ਸਕਦਾ ਤਰੀਕੇ ਨਾਲ ਤਾਂ ਉਹਨੂੰ ਮੇਰੇ ਖਿਆਲ ਨਾਲ ਹਿੰਦੀ ਸਮਝਣੀ ਕੋਈ ਜ਼ਿਆਦਾ ਔਖੀ ਨਹੀਂ ਉਹ ਹਿੰਦੀ ਸਮਝ ਵੀ ਸਕਦਾ ਹਿੰਦੀ ਬੋਲ ਵੀ ਸਕਦਾ ਅਤੇ ਬਾਕੀ ਜੇ ਦੇਖਿਆ ਜਾਵੇ ਸਾਡੇ ਇੱਥੇ ਦਸਵੀਂ ਤੱਕ ਪੰਜਾਬੀ ਹਿੰਦੀ ਦੋਨੇਂ ਭਾਸ਼ਾਵਾਂ ਹੀ ਚੱਲਦੀਆਂ ਨੇ ਅਤੇ ਇਹਦੇ 'ਚ ਕੋਈ ਵੀ ਜ਼ਿਆਦਾ ਉਹ ਕਨਫਿਊਜ਼ਨ ਨਹੀਂ ਹੈਗੀ ਪੰਜਾਬੀ ਹਿੰਦੀ ਦੋਨੇਂ ਭਾਸ਼ਾਵਾਂ ਹੀ ਕਾਫ਼ੀ ਹੱਦ ਤੱਕ ਇੱਕ ਦੂਜੇ ਦੇ ਬਿਲਕੁਲ ਨਜ਼ਦੀਕ ਨੇ ਪੰਜਾਬੀ ਭਾਸ਼ਾ ਬੋਲਣ ਵਾਲਾ ਬੰਦਾ ਹਿੰਦੀ ਸਮਝ ਵੀ ਸਕਦਾ ਹਿੰਦੀ ਬੋਲ ਵੀ ਸਕਦਾ ਅਤੇ ਇਸੇ ਤਰ੍ਹਾਂ ਹੀ ਹਿੰਦੀ ਵਾਲਾ ਹਿੰਦੀ ਵਾਲੇ ਦੇ ਹਿੰਦੀ ਵਾਲਾ ਵੀ ਪੰਜਾਬੀ ਨੂੰ ਵਧੀਆ ਤਰੀਕੇ ਨਾਲ ਸੁਣ ਸਕਦਾ ਸਮਝ ਸਕਦਾ ਬੋਲ ਸਕਦਾ ਅਤੇ ਇਹ ਦੋਨੇਂ ਭਾਸ਼ਾਵਾਂ ਇੱਕ ਦੂਜੇ ਦੇ ਕਾਫ਼ੀ ਹੱਦ ਤੱਕ ਇੱਕ ਦੂਜੇ ਦੇ ਨੇੜੇ ਨੇ ਅਤੇ ਅਸੀਂ ਦੇਖਦੇ ਹਾਂ ਆਸੇ ਪਾਸੇ ਬਹੁਤ ਜੋ ਮਤਲਬ ਬਾਹਰਲੀਆਂ ਸਟੇਟਾਂ ਦੇ ਸਟੂਡੈਂਟ ਨੇ ਆਉਂਦੇ ਨੇ ਤਾਂ ਉਹ ਪੰਜਾਬ ਜਿਹੜੇ ਪਿਓਰ ਪੰਜਾਬੀ ਨੇ ਉਨ੍ਹਾਂ ਨਾਲ ਜਦੋਂ ਗੱਲਬਾਤ ਕਰਦੇ ਨੇ ਤਾਂ ਉਨ੍ਹਾਂ ਦੀਆਂ ਗੱਲਾਂ ਇੱਕ ਦੂਜੇ ਨੂੰ ਸਮਝ ਆਉਂਦੀਆਂ ਨੇ ਉਨ੍ਹਾਂ ਦਾ ਇੱਕ ਦੂਜੇ ਨਾਲ ਗੱਲ ਕਰਨ ਦਾ ਜੋ ਓ ਕਮਨੀਕੇਸ਼ਨ ਹੁੰਦੀ ਹੈ ਜਾਂ ਵਾਰਤਾਲਾਪ ਹੁੰਦਾ ਹੈਗਾ ਤਾਂ ਇੱਕ ਪਾਸੇ ਹਿੰਦੀ ਜੇ ਕਿਤੇ ਬੰਦਾ ਹਿੰਦੀ ਬੋਲਦਾ ਤਾਂ ਦੂਜਾ ਬੰਦਾ ਆਸਾਨੀ ਨਾਲ ਉਹਦੀ ਸਮਝ ਸਕਦਾ ਹਿੰਦੀ ਅਤੇ ਜੋ ਵੀ ਜਰਨਲ ਇੱਕ ਦੂਜੇ ਦੇ ਵਿੱਚ ਵਾਰਤਾਲਾਪ ਹੁੰਦੀ ਆ ਹਿੰਦੀ ਪੰਜਾਬੀ ਇੱਕ ਦੂਜੇ ਦੁਆਰਾ ਚੰਗੀ ਤਰ੍ਹਾਂ ਸਮਝੀ ਜਾਂਦੀ ਆ